ਮੈਂ ਵਰਿੰਦਰ ਕੁਮਾਰ ਜ਼ਿਲ੍ਹਾ ਪਠਾਨਕੋਟ ਦਾ ਰਹਿਣ ਵਾਲਾ ਹਾਂ ਮੈਂ ਦੱਸਣਾ ਚਾਹੁੰਦਾ ਕਿ ਭਾਰਤ ਵਿੱਚ ਬਹੁਤ ਸਾਰੇ ਤਿਉਹਾਰ ਮਨਾਏ ਜਾਂਦੇ ਹਨ ਜਿਵੇਂ ਦੀਵਾਲੀ ਦੁਸਹਿਰਾ ਵਿਸਾਖੀ ਆਦਿ ਪਰ ਜੇਕਰ ਅਸੀਂ ਦੀਵਾਲੀ ਦੀ ਗੱਲ ਕਰੀਏ ਤਾਂ ਭਾਰਤ ਵਿੱਚ ਦੀਵਾਲੀ ਸ਼੍ਰੀ ਰਾਮ ਚੰਦਰ ਜੀ ਦੇ ਨਾਮ 'ਤੇ ਮਨਾਈ ਜਾਂਦੀ ਹੈ ਜਿਵੇਂ ਕਿ ਸ਼੍ਰੀ ਰਾਮ ਚੰਦਰ ਜੀ ਅਯੋਧਿਆ ਵਾਪਸ ਆਏ ਸਨ ਜਦੋਂ ਉਹ ਚੌਦਾਂ ਸਾਲਾਂ ਦਾ ਬਨਵਾਸ ਕੱਟ ਕੇ ਵਾਪਸ ਅਯੋਧਿਆ ਆਏ ਸਨ ਤਾਂ ਦੀਵਾਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਉਹਨਾਂ ਦੇ ਆਉਣ ਦੀ ਖੁਸ਼ੀ ਵਿੱਚ ਲੋਕਾਂ ਨੇ ਦੀਪਮਾਲਾ ਕੀਤੀ ਅੱਜ ਜੇਕਰ ਅਸੀਂ ਭਾਰਤ ਦੇਸ਼ ਦੀ ਗੱਲ ਕਰੀਏ ਤਾਂ ਉਹਨਾਂ ਦੀ ਉਹਨਾਂ ਦੀ ਪ੍ਰਸਿੱਧੀ ਸਾਡੇ ਦੇਸ਼ ਅਯੋਧਿਆ ਵਿੱਚ ਸ਼੍ਰੀ ਰਾਮ ਜੀ ਜੀ ਦੇ ਇੱਕ ਵਿਸ਼ਾਲ ਮੰਦਰ ਬਣ ਗਿਆ ਹੈ ਇੱਥੇ ਲੋਕ ਬੜੇ ਵਧੀਆ ਤਰੀਕੇ ਨਾਲ ਜਾ ਕੇ ਅਲੱਗ ਅਲੱਗ ਲਹਿਰਾਂ ਰਹਿਤ ਝੰਡੇ ਲਹਿਰਾ ਰਹੇ ਹਨ ਜੇਕਰ ਅਸੀਂ ਦੂਜੇ ਤਿਉਹਾਰ ਦੁਸਹਿਰੇ ਦੀ ਗੱਲ ਕਰੀਏ ਤਾਂ ਬੜੀ ਧੂਮ ਧਾਮ ਨਾਲ ਮਜਾਇਆ ਮਨਾਇਆ ਜਾਂਦਾ ਹੈ ਜਿਵੇਂ ਦੁਸਹਿਰੇ ਵਿੱਚ ਰਾਵਣ ਮੇਘਨਾਥ ਕੁੰਭਕਰਨ ਦੇ ਪੁਤਲੇ ਬਣਾ ਕੇ ਸਾੜੇ ਜਾਂਦੇ ਹਨ ਇਸ ਤਿਉਹਾਰ ਨੂੰ ਨੇਕੀ 'ਤੇ ਬਦੀ ਦੀ ਜਿੱਤ ਆਖਦੇ ਹਨ ਦੁਸਹਿਰਾ ਸ਼੍ਰੀ ਰਾਮ ਚੰਦਰ ਜੀ ਨੇ ਰਾਵਣ ਨੂੰ ਮਾਰ ਕੇ ਸੀਤਾ ਨੂੰ ਵਾਪਸ ਲੰਕਾ ਲਿਆਂਦਾ ਸੀ ਉਹਨਾਂ ਨੂੰ ਸਾੜਨ ਲਈ ਜਦੋਂ ਇਤਿਹਾਸ ਵਿੱਚ ਇਹ ਤਿਉਹਾਰ ਮਨਾਇਆ ਜਾਂਦਾ ਹੈ ਜੇਕਰ ਅਸੀਂ ਵਿਸਾਖੀ ਦੀ ਗੱਲ ਕਰੀਏ ਤਾਂ ਇਹ ਤਿਉਹਾਰ ਤੇਰ੍ਹਾਂ ਅਪ੍ਰੈਲ ਨੂੰ ਮਨਾਇਆ ਜਾਂਦਾ ਹੈ ਵਿਸਾਖੀ ਵਾਲੇ ਦਿਨ ਕਿਸਾਨਾਂ ਦੀ ਕਣਕ ਦੀ ਫ਼ਸਲ ਜ ਫ਼ਸਲ ਪੂਰੀ ਤਰ੍ਹਾਂ ਪੱਕ ਕੇ ਤਿਆਰ ਹੋ ਹੁੰਦੀ ਹੈ ਉਸ ਵੇਖ ਕੇ ਕਿਸਾਨ ਖੁਸ਼ ਹੁੰਦੇ ਹਨ ਉਹ ਇਹ ਤਿਉਹਾਰ ਮਨਾਉਂਦੇ ਹਨ ਪੁਰਾਣੇ ਸਮੇਂ ਵਿੱਚ ਵਿਸਾਖੀ 'ਤੇ ਬੜੇ ਹੀ ਭਾਰੀ ਮੇਲੇ ਲੱਗਦੇ ਸਨ ਕਿਸਾਨ ਗ ਨੱਚਦੇ ਗਾਉਂਦੇ ਭੰਗੜੇ ਪਾਉਂਦੇ ਮੇਲੇ ਵਿੱਚ ਜਾਂਦੇ ਇਹਨਾਂ ਤਿਉਹਾਰਾਂ 'ਤੇ ਸਾਡੇ ਭਾਰਤ ਵਿੱਚ ਛੁੱਟੀਆਂ ਹੁੰਦੀਆਂ ਹਨ ਅਤੇ ਲੋਕ ਛੁੱਟੀਆਂ ਦੇ ਨਾਲ ਨਾਲ ਇਹਨਾਂ ਮੇਲਿਆਂ ਨੂੰ ਜਾਂ ਇਹਨਾਂ ਤਿਉਹਾਰਾਂ ਨੂੰ ਮਨਾਉਂਦੇ ਹਨ ਇਸ ਤੋਂ ਇਲਾਵਾ ਹੋਰ ਵੀ ਕਹਿ ਕਈ ਅਜਿਹੇ ਤਿਉਹਾਰ ਹਨ ਜੋ ਭਾਰਤ ਵਿੱਚ ਜਾਂ ਪੰਜਾਬ ਵਿੱਚ ਮਨਾਏ ਜਾਂਦੇ ਹਨ ਅਤੇ ਉਸ ਮੌਕੇ ਛੁੱਟੀਆਂ ਹੁੰਦੀਆਂ ਹਨ ਧੰਨਵਾਦ ਜੀ